ਮੈਂ ਆਪਣੇ ਬਚਪਨ ਦੇ ਵਿੱਚ ਆਪਣੇ ਨਾਨਕੇ ਘਰ ਬਹੁਤ ਜਾਂਦੀ ਸੀ ਮੇਰੇ ਮਾਮਾ ਜੀ ਇੱਕ ਡਿਪਟੀ ਕਮਿਸ਼ਨਰ ਅਫਸਰ ਸਨ ਅਤੇ ਆਪਣੀ ਨੌਕਰੀ ਤੋਂ ਰਿਟਾਇਰ ਹੋ ਕੇ ਉਹਨਾਂ ਨੇ ਕਿਤਾਬਾਂ ਲਿਖਣੀਆਂ ਸ਼ੁਰੂ ਕੀਤੀਆਂ ਉਹ ਬਹੁਤ ਵਧੀਆ ਵਧੀਆ ਨਾਵਲ ਲਿਖਦੇ ਹਨ ਤਾਂ ਉਹਨਾਂ ਨੇ ਇੱਕ ਨਾਵਲ ਲਿਖਿਆ ਕੌਣ ਦਿਲਾਂ ਦੀਆਂ ਜਾਣੇ ਇਸ ਨਾਵਲ ਦੇ ਵਿੱਚ ਉਹਨਾਂ ਨੇ ਸਾਡੇ ਬਚਪਨ ਦੀਆਂ ਕੁਛ ਅਜਿਹੀਆਂ ਚੀਜ਼ਾਂ ਲਿਖੀਆਂ ਜਿਨ੍ਹਾਂ ਨੂੰ ਕਿ ਪੜ੍ਹ ਕੇ ਮੈਨੂੰ ਬਹੁਤ ਹੀ ਹਾਸਾ ਆਉਂਦਾ ਜਿਸ ਤਰ੍ਹਾਂ ਕਿ ਜਦੋਂ ਮੈਂ ਛੋਟੀ ਜਿਹੀ ਹੁੰਦੀ ਸੀਗੀ ਘਰੇ ਜਿਹੜਾ ਮੇਜ਼ 'ਤੇ ਲੱਗ ਕੇ ਪੱਖਾ ਹੁੰਦੇ ਹੈ ਉਹ ਪੱਖਾ ਚੱਲ ਰਿਹਾ ਸੀਗਾ ਉਹ ਪੱਖੇ ਦਾ ਪਿੱਛੋਂ ਕਿਤੇ ਮੈਨੂੰ ਹੱਥ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ ਰੋਣਾ ਸ਼ੁਰੂ ਕਰ ਦਿੱਤਾ ਤਾਂ ਸਾਡੀ ਕਿਉਂਕਿ ਉੱਥੇ ਸਮੁੱਚਾ ਪਰਿਵਾਰ ਸੀਗਾ ਅਤੇ ਮੈਂ ਉੱਚੀ ਉੱਚੀ ਰੋਣ ਲੱਗ ਗਈ ਤਾਂ ਮੇਰੀ ਮੰਮੀ ਦੇ ਜਿਹੜੇ ਤਾਇਆ ਜੀ ਸਨ ਉਹ ਕਹਿੰਦੇ ਵੀ ਤੂੰ ਕਿਉਂ ਰੋ ਰਹੀ ਹੈ ਮੈਂ ਕਿਹਾ ਵੀ ਦੇਖੋ ਮੇਰੇ ਇਹਨੂੰ ਹੱਥ ਲੱਗ ਗਿਆ ਸੀਗਾ ਜੇ ਮੈਨੂੰ ਕਰੰਟ ਆ ਜਾਂਦਾ ਫਿਰ ਕੀ ਹੋ ਜਾਂਦਾ ਅਤੇ ਉਹ ਬਹੁਤ ਹੱਸੇ ਇਸ ਗੱਲ 'ਤੇ ਉਹ ਕਹਿੰਦੇ ਵੀ ਤੈਨੂੰ ਕਰੰਟ ਆਇਆ ਥੋੜ੍ਹੀ ਹੈ ਜੇ ਆਇਆ ਹੁੰਦਾ ਫਿਰ ਆਪਾਂ ਦੇਖਦੇ ਤੂੰ ਤਾਂ ਐਵੇਂ ਰੋਈ ਜਾਂਦੀ ਹੈ ਇਹ ਸੋਚ ਕੇ ਵੀ ਜੇ ਮੈਨੂੰ ਕਰੰਟ ਲੱਗ ਜਾਂਦਾ ਫਿਰ ਕੀ ਹੋ ਜਾਂਦਾ ਮੈਂ ਤਾਂ ਮਰ ਜਾਂਦੀ ਸੋ ਇਹ ਗੱਲ ਨੂੰ ਪੜ੍ਹ ਕੇ ਮੈਨੂੰ ਬਹੁਤ ਹੀ ਹਾਸਾ ਆਇਆ ਮੈਂ ਲਗਾਤਾਰ ਹੱਸਦੀ ਰਹੀ ਹੱਸਦੀ ਰਹੀ ਅਤੇ ਮੈਨੂੰ ਆਪਦਾ ਉਹ ਬਚਪਨ ਦਾ ਸਾਰਾ ਹੀ ਦ੍ਰਿਸ਼ ਯਾਦ ਆ ਗਿਆ ਦੂਜੀ ਇੱਕ ਗੱਲ ਹੋਰ ਕਿ ਉਹਨਾਂ ਨੇ ਲਿਖਿਆ ਕਿ ਜਦੋਂ ਮੈਂ ਛੋਟੀ ਹੁੰਦੀ ਸੀ ਚੱਲਣਾ ਸਿੱਖਿਆ ਸਿੱਖਿਆ ਸੀਗਾ ਤਾਂ ਸਾਡੀ ਛੱਤ 'ਤੇ ਚੁਬਾਰੇ ਬਣੇ ਹੋਏ ਸੀਗੇ ਤੋ ਜੋ ਛੱਤ 'ਤੇ ਚੁਬਾਰੇ ਸੀਗੇ ਉਹਦੇ ਨਾ ਖਿੜਕੀ 'ਤੇ ਗਰਿੱਲ ਲੱਗੀ ਹੋਈ ਸੀਗੀ ਗਰਿੱਲ ਵਿੱਚੋਂ ਸੀਗੀ ਚੋੜੀ ਤਾਂ ਕਿਉਂਕਿ ਮੈਂ ਬਚਪਨ ਦੇ ਵਿੱਚ ਬਹੁਤ ਹੀ ਸ਼ਰਾਰਤੀ ਹੁੰਦੀ ਸੀਗੀ ਇਸ ਲਈ ਜਦੋਂ ਮੈਂ ਕੀ ਕੀਤਾ ਕਿ ਸ਼ਰਾਰਤਾਂ ਕਰਦੇ ਕਰਦੇ ਮੈਂ ਉਹ ਖਿੜਕੀ ਖੋਲ ਲਈ ਗਰਿੱਲ ਦੇ ਵਿੱਚੋਂ ਨਿਕਲ ਗਈ ਗਰਿੱਲ ਦੇ ਵਿੱਚੋਂ ਨਿਕਲ ਕੇ ਤਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਪੁਰਾਣੇ ਆਪਣੇ ਜਮਾਨੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਹੁੰਦੀਆਂ ਹੈ ਸੜਕਾਂ 'ਤੇ ਥੋੜ੍ਹੀਆਂ ਘਰਾਂ ਦੇ ਪਹਿਲੀ ਮੰਜ਼ਿਲ ਦੇ ਬਰਾਬਰ ਜਿਹੇ ਹੁੰਦੀਆਂ ਨੇ ਤੇ ਮੈਂ ਕੀ ਕੀਤਾ ਕੀ ਉਹਦੇ ਚੋਂ ਨਿਕਲ ਕੇ ਡਿੱਗੀ ਤਾਂ ਮੈਂ ਬਿਜਲੀ ਦੀਆਂ ਤਾਰਾਂ ਦੇ ਅੱੜਕ ਗਈ ਬਿਜਲੀ ਦੀਆਂ ਤਾਰਾਂ ਦੇ ਵਿੱਚ ਅੜਕ ਗਈ ਅਤੇ ਮੈਂ ਉੱਚੀ ਉੱਚੀ ਰੋਈ ਜਾਵਾਂ ਵੀ ਇਹ ਕੀ ਹੋਇਆ ਇਹ ਕੀ ਹੋਇਆ ਆਸੇ ਪਾਸੇ ਲੋਕਾਂ ਨੇ ਦੇਖਿਆ ਵੀ ਇਹ ਤਾਂ ਕਿਉਂ ਉੱਚੀ ਉੱਚੀ ਰੋਈ ਜਾਂਦੀ ਹੈ ਫਿਰ ਉਹਨਾਂ ਨੇ ਸੋਟੀ ਦੇ ਨਾਲ ਬਿਜਲੀ ਦੀ ਤਾਰਾਂ ਨੂੰ ਹਿਲਾਇਆ ਬਿਜਲੀ ਦੀਆਂ ਤਾਰਾਂ ਨੂੰ ਹਿਲਾ ਕੇ ਮੈਨੂੰ ਨੀਚੇ ਸਿੱਟਿਆ ਨੀਚੇ ਸਿੱਟਿਆ ਅਤੇ ਮੈਂ ਆਪਦੇ ਕੱਪੜੇ ਝਾੜ ਕੇ ਖੜੀ ਹੋ ਗਈ ਲੋਕ ਮੇਰਾ ਪਤਾ ਲੈਂਦੇ ਆਈ ਜਾਣ ਅਤੇ ਮੈਂ ਆਪਦਾ ਹੱਸੀ ਜਾਵਾਂ ਖੇਡੀ ਜਾਵਾਂ ਸੋ ਜਦੋਂ ਮੈਂ ਇਹ ਚੀਜ਼ ਪੜ੍ਹੀ ਤਾਂ ਮੈਨੂੰ ਬੜਾ ਹੀ ਹਾਸਾ ਆਇਆ ਮੈਂ ਲਗਾਤਾਰ ਹੱਸਦੀ ਰਹੀ ਹੱਸਦੀ ਰਹੀ ਇਹ ਚੀਜ਼ਾਂ ਇੱਕ ਦੋ ਘਟਨਾਵਾਂ ਅਜਿਹੀਆਂ ਮੇਰੇ ਮਾਮਾ ਜੀ ਨੇ ਆਪਦੇ ਨਾਵਲ ਦੇ ਵਿੱਚ ਲਿਖੀਆਂ ਜਿਨ੍ਹਾਂ ਨੇ ਕਿ ਮੈਨੂੰ ਬਹੁਤ ਹੀ ਹੱਸਣ 'ਤੇ ਮਜ਼ਬੂਰ ਕੀਤਾ